ਪੰਜਾਬ ਵਿੱਚ ਕਈ ਤਰ੍ਹਾਂ ਪ੍ਰਕਾਰ ਦੇ ਸੱਭਿਆਚਾਰਕ ਸਮਾਗਮ ਹੁੰਦੇ ਰਹਿੰਦੇ ਆ ਸਾਲ ਦੇ ਸ਼ੁਰੂ ਹੁੰਦਿਆਂ ਸਾਰ ਹੀ ਸਮਾਗਮ ਅਤੇ ਤਿਉਹਾਰ ਸ਼ੁਰੂ ਹੋ ਜਾਂਦੇ ਆ ਜਿਵੇਂ ਕਈ ਗੁਰਪੁਰਬ ਆਉਂਦੇ ਹਨ ਅਤੇ ਕਈ ਤਿਉਹਾਰ ਵੀ ਜਿਵੇਂ ਲੋਹੜੀ ਵਿਸਾਖੀ ਹੋਲੀ ਰੱਖੜੀ ਦੀਵਾਲੀ ਆਦਿ ਸਾਡੇ ਦਸਾਂ ਪਾਤਸ਼ਾਹੀਆਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਵਸ ਮਨਾਏ ਜਾਂਦੇ ਆ ਇਹ ਸਾਰਾ ਕੁਝ ਪੂਰੇ ਸਾਲ ਹੀ ਹੁੰਦਾ ਰਹਿੰਦਾ ਹੈ ਤਿਉਹਾਰਾਂ ਨੂੰ ਸਾਰੇ ਲੋਕ ਆਪਣੇ ਆਪਣੇ ਧਰਮਾਂ ਅਨੁਸਾਰ ਮਨਾਉਂਦੇ ਆ ਜਿਸ ਨਾਲ ਉਹਨਾਂ ਦਾ ਕਾਫੀ ਹੱਦ ਤੱਕ ਮਨੋਰੰਜਨ ਵੀ ਹੁੰਦਾ ਹੈ ਸਾਲ ਵਿੱਚ ਕਈਆਂ ਦੇ ਵਿਆਹ ਅਤੇ ਸ਼ਾਦੀਆਂ ਵੀ ਹੁੰਦੀਆਂ ਜਿਸ ਵਿੱਚ ਲੋਕ ਗਿੱਧਾ ਭੰਗੜਾ ਆਦਿ ਪਾਉਂਦੇ ਆ ਜਿਸ ਦੇ ਨਾਲ ਉਹਨਾਂ ਦਾ ਬਹੁਤ ਸਾਰਾ ਮਨੋਰੰਜਨ ਹੁੰਦਾ ਹੈ ਅਤੇ ਉਹਨਾਂ ਨੂੰ ਖੁਸ਼ੀ ਵੀ ਮਿਲਦੀ ਹੈ ਪੰਜਾਬ ਦੇ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਬਹੁਤ ਸਾਰੇ ਮਨੋਰੰਜਨ ਹੁੰਦੇ ਹੀ ਰਹਿੰਦੇ ਆ